ਆਪਣੇ ਖਾਣਾ ਬਣਾਉਣ ਵਾਸਤੇ ਅਸੀਂ ਬਹੁਤ ਸਾਰੀ ਜੜੀ ਬੂਟੀਆਂ ਦੀ ਵਰਤੋਂ ਕਰਦੇ ਹਾਂ ਜਿਹਨਾਂ ਵਿੱਚ ਕਿ ਨੰਬਰ ਇੱਕ 'ਤੇ ਜਵੈਣ ਆਉਂਦੀ ਹੈ ਫਿਰ ਹਲਦੀ ਆਉਂਦੀ ਹੈ ਮੇਥੇ ਆਉਂਦੇ ਹਨ ਇਸ ਤੋਂ ਇਲਾਵਾ ਸੁੰਢ ਆਉਂਦੀ ਹੈ ਤੁਲਸੀ ਆਉਂਦੀ ਹੈ ਅਸੀਂ ਹਰੇ ਪੁਦੀਨੇ ਦਾ ਵੀ ਵਰਤੋਂ ਕਰਦੇ ਹਾਂ ਹਰ ਪੁਦੀਨਾ ਆ ਜਾਂਦਾ ਹੈ ਅਤੇ ਇਹ ਇਹਨਾਂ ਸਾਰੀਆਂ ਜੜੀ ਬੂਟੀਆਂ ਦੀ ਵਰਤੋਂ ਕਰਦੇ ਹਾਂ ਅਤੇ ਸਾਰੀਆਂ ਜਿਹੜੀਆਂ ਬੂਟੀਆਂ ਅਸੀਂ ਘਰ 'ਚ ਉਗਾ ਵੀ ਸਕਦੇ ਹਾਂ ਆਪਣੇ ਕਿਚਨ ਗਾਰਡਨ ਵਿੱਚ ਅਸੀਂ ਸੁੰਢ ਉਗਾ ਸਕਦੇ ਹਾਂ ਅਸੀਂ ਅਰਬੀ ਉਗਾ ਸਕਦੇ ਹਾਂ ਅਸੀਂ ਅਲੈਚੀ ਦਾ ਪੌਦਾ ਲਗਾ ਸਕਦੇ ਹਾਂ ਅਸੀਂ ਜਵੈਣ ਵਾਲਾ ਅਤੇ ਪੌਦਾ ਲਗਾ ਸਕਦੇ ਹਾਂ ਤੁਲਸੀ ਦਾ ਪੌਦਾ ਲਗਾ ਸਕਦੇ ਹਾਂ ਇਸ ਦੇ ਨਾਲ ਹੀ ਅਸੀਂ ਸੁੰਢ ਵੀ ਉਗਾ ਸਕਦੇ ਹਾਂ ਸਾਰੀਆਂ ਜੜੀਆਂ ਬੂਟੀਆਂ ਜਿਹੜੀਆਂ ਹਨ ਮੇਥੇ ਹਨ ਮੇਥੇ ਅਸੀਂ ਬਹੁਤ ਈਜ਼ੀਲੀ ਗਮਲੇ ਵਿੱਚ ਵੀ ਉਗਾ ਸਕਦੇ ਹਾਂ ਸੋ ਇਹ ਸਾਰੀਆਂ ਜਿਹੜੀਆਂ ਜੜੀਆਂ ਬੂਟੀਆਂ ਹਨ ਉਹ ਅਸੀਂ ਇਜ਼ੀਲੀ ਗਮਲਿਆਂ ਦੇ ਵਿੱਚ ਵੀ ਅਤੇ ਧਰਤੀ ਦੇ ਵਿੱਚ ਵੀ ਉਗਾ ਸਕਦੇ ਹਾਂ ਅਤੇ ਇਹਨਾਂ ਦੀ ਜਿਹੜੀ ਵਰਤੋਂ ਹੈ ਅਸੀਂ ਉਹ ਕਰ ਸਕਦੇ ਹਾਂ